ਸਾਡਾ ਰਾਜ ਸਮਾਜ ਦਾ ਸੱਭਿਆਚਾਰ ਜਿਵੇਂ ਕੀ ਸਾਡਾ ਪੰਜਾਬੀ ਸੱਭਿਆਚਾਰ ਹੈ ਕੁੜਤਾ ਪਜਾਮਾ ਜਨਾਨੀਆਂ ਦਾ ਹੈ ਸਲਵਾਰ ਸੂਟ ਇਹ ਸਾਡੇ ਪੰਜਾਬੀ ਬੰਦੇ ਪੱਗ ਵੀ ਬੰਨਦੇ ਹਨ ਜੋ ਕਿ ਬਹੁਤ ਜ਼ਿਆਦਾ ਜੱਚਦੀ ਹੈ ਸਾਡ ਸਾਡੇ ਪਹਿਰਾਵੇ ਵਿੱਚ ਬਹੁਤ ਹੀ ਜ਼ਿਆਦਾ ਕੰਫਰਟੇਬਲ ਰਹਿੰਦੇ ਹਨ ਜੋ ਕਿ ਬੰਦਾ ਦੂਸਰਾ ਦੇਖ ਕੇ ਹੀ ਦੱਸ ਦਿੰਦਾ ਹੈ ਪੰਜਾਬੀ ਹੈ ਜਾਂ ਹੋਰ ਕੋਈ ਗਹਿਣੇ ਵਿੱਚ ਜਨਾ ਹ ਜਨਾਨੀ ਆਪਣੇ ਸੁਰਖੀ ਬਿੰਦੀ ਅਤੇ ਮੰਗਲ ਸੂਤਰ ਪਾਉਂਦੀ ਹੈ ਅਤੇ ਬੰਦੇ ਆਪਣਾ ਸਿਰਫ਼ ਵਾਲਾਂ ਨੂੰ ਹੀ ਸੈੱਟ ਕਰਦੇ ਹਨ ਅਤੇ ਪੱਗ ਬੰਨਦੇ ਹਨ